ਅਜਿਹਾ ਵਿਅਕਤੀ ਜੋ ਕਿ ਜਿਸਨੇ ਹੁਣੇ ਹੁਣੇ ਚਿੱਤਰਕਾਰੀ ਸ਼ੁਰੂ ਕੀਤੀ ਹੈ ਉਹ ਉਸ ਦੇ ਲਈ ਸਭ ਤੋਂ ਵਧੀਆ ਸਲਾਹ ਇਹੀ ਹੈ ਕਿ ਅਗਰ ਉਹ ਆਪਣੇ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਅੱਜ ਬਹੁਤ ਸਾਰੇ ਟੈਕਨੋਲਜੀ ਨੇ ਸਾਨੂੰ ਸਾਧਨ ਦਿੱਤੇ ਹਨ ਸਭ ਤੋਂ ਪਹਿਲਾਂ ਗੂਗਲ ਦੇ ਉੱਤੇ ਸਰਚ ਕਰਕੇ ਕਿਸੇ ਵੀ ਮਤਲਬ ਕਿ ਮੰਨ ਲਓ ਚਿੱਤਰ ਬਣਾਉਣਾ ਚਾਹੁੰਦਾ ਹੈ ਮੰਨ ਲਓ ਗਾਂਧੀ ਜੀ ਦਾ ਚਿੱਤਰ ਉਹ ਬਣਾਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਸ਼ੁਰੂਆਤ ਕਿਵੇਂ ਕਰਨੀ ਹੈ ਬੇਸਿਕਸ ਕੀ ਹਨ ਕ ਕਿਵੇਂ ਸ਼ੁਰੂ ਕਰਨਾ ਹੈ ਕਿਵੇਂ ਕਰਨਾ ਹੈ ਉਹਦੇ ਲਈ ਬਹੁਤ ਸਾਰੀਆਂ ਉਦਾਹਰਨਾਂ ਹਨ ਇਸ ਤੋਂ ਇਲਾਵਾ ਯੂਟਿਊਬ ਦੀ ਵਰਤੋਂ ਕਰਕੇ ਉਹ ਵਿਅਕਤੀ ਜਿਹੜੀ ਇੱਕ ਡਰਾਇੰਗ ਹੈ ਉਸਨੂੰ ਬਣਦੇ ਚਿੱਤਰਕਾਰੀ ਜਿਹੜੀ ਹੈ ਉਸ ਨੂੰ ਸ਼ੁਰੂਆ ਸ਼ੁਰੂ ਕਿਸ ਤਰ੍ਹਾਂ ਕਰਨਾ ਹੈ ਅੱਗੇ ਕਿਸ ਤਰਾਂ ਲੈ ਕੇ ਜਾਣਾ ਹੈ ਸੋ ਉਹ ਜਿਹੜੀਆਂ ਲਾਈਨਾਂ ਨੂੰ ਖਿੱਚਣ ਦਾ ਹੁਨਰ ਹੈ ਉਹ ਉਹ ਬੜੀ ਭਲੀ ਭਾਂਤੀ ਯੂਟਿਊਬ ਤੋਂ ਵੀ ਸਿੱਖ ਸਕਦਾ ਹੈ ਇਸ ਤੋਂ ਇਲਾਵਾ ਆਲੇ ਦੁਆਲੇ ਤੋਂ ਜਿਹੜੀ ਹੈ ਕੋਈ ਵੀ ਪ੍ਰਵੀਨ ਵਿਅਕਤੀ ਹੈ ਉਸ ਦੀ ਸਲਾਹ ਦੇ ਨਾਲ ਵੀ ਉਹ ਹੋਰ ਆਪਣੇ ਹੁਨਰ ਨੂੰ ਜਿਹੜਾ ਹੈ ਉਹ ਨਿਖਾਰ ਸਕਦਾ ਹੈ ਅਤੇ ਆਪਣੇ ਹੁਨਰ ਦੇ ਵਿੱਚ ਉਹ ਪ੍ਰਵੀਨ ਬਣ ਸਕਦਾ ਹੈ